ਸਿੱਖ ਧਰਮ ਦਾ ਜੋ ਮੁੱਢਲਾ ਸਿਧਾਂਤ ਹੈ ਉਹ ਹੈ ਕਿ ਸਰਬੱਤ ਦਾ ਭਲਾ ਜੋ ਕਿ ਹਰ ਇੱਕ ਸਿੱਖ ਅਰਦਾਸ ਰਾਹੀਂ ਪੂਰੀ ਦੁਨੀਆਂ ਦੇ ਵਿੱਚ ਮੰਗਦਾ ਰਹਿੰਦਾ ਹੈ ਕੇਵਲ ਮੰਗਦਾ ਹੀ ਨਹੀਂ ਹੈ ਸੇਵਾ ਦੇ ਵਿੱਚ ਹਾਜ਼ਰ ਵੀ ਰਹਿੰਦਾ ਹੈ ਜਦੋਂ ਜਦੋਂ ਮਨੁੱਖਤਾ ਨੂੰ ਲੋੜ ਹੁੰਦੀ ਹੈ ਇਸ ਤਰ੍ਹਾਂ ਹੀ ਪੰਜਾਬ ਦੇ ਹੋਰ ਜੋ ਧਰਮ ਹਨ ਚਾਹੇ ਉਹ ਸਨਾਤਨ ਧਰਮ ਹੋਵੇ ਇਸਲਾਮ ਧਰਮ ਹੋਵੇ ਉਹ ਸਾਰੇ ਹੀ ਕਿਤੇ ਨਾ ਕਿਤੇ ਜੋ ਗੁਰੂ ਮਹਾਰਾਜ ਦੀ ਸਿੱਖਿਆਵਾਂ ਦੀ ਛੋਹ ਪ੍ਰਾਪਤ ਕਰਕੇ ਉਸੇ ਹੀ ਰੰਗ ਦੇ ਵਿੱਚ ਰੰਗੇ ਗਏ ਹਨ ਅਤੇ ਉਹ ਵੀ ਬਹੁਤ ਹੀ ਦਲੇਰੀ ਦੇ ਨਾਲ ਬੜੇ ਪਿਆਰ ਅਤੇ ਸਨੇਹ ਦੇ ਨਾਲ ਦੁਨੀਆ ਦੇ ਵਿੱਚ ਵਿਚਰ ਰਹੇ ਹਨ ਅਤੇ ਗੁਰੂ ਮਹਾਰਾਜ ਦਾ ਸੁਨੇਹਾ ਵੱਖ ਵੱਖ ਢੰਗਾਂ ਦੇ ਨਾਲ ਲੈ ਕੇ ਜਾ ਰਹੇ ਹਨ